ਬਾਈ ਮਈ ਦੋ ਹਜ਼ਾਰ ਦਸ ਬਾਰ੍ਹਾਂ ਮਾਰਚ ਦੋ ਹਜ਼ਾਰ ਵੀਹ ਤੇਈ ਜਨਵਰੀ ਦੋ ਹਜ਼ਾਰ ਇੱਕੀ ਸੋਲਾਂ ਨਵੰਬਰ ਦੋ ਹਜ਼ਾਰ ਅੱਠ ਦੋ ਅਕਤੂਬਰ ਦੋ ਹਜ਼ਾਰ ਉੱਨੀ